ਹਾਂਜੀ ਸਰ ਕੌਣ ਜੀ ਹਾਂਜੀ ਸਰ ਹਾਂਜੀ ਸਰ ਅਸੀਂ ਫਰਨੀਚਰ ਲੈਣਾ ਸੀਗਾ ਅਸੀਂ ਤੁਹਾਡੀ ਸ਼ੋਪ ਸਰ ਕਿੱਥੇ ਆ ਠੀਕ ਹੈ ਸਰ ਆਪਣੇ ਕੋਲ ਨਿਊ ਫਰਨੀਚਰ ਵੀ ਹੁੰਦਾ ਸਰ ਅੱਛਾ ਜੀ ਮਤਲਬ ਸੈਕਿੰਡ ਹੈਂਡ ਠੀਕ ਹੈ ਸਰ ਠੀਕ ਹੈ ਜੀ ਅਪ ਸਰ ਆਪਣਾ ਐਡਰੈਸ ਦਿਓ ਕਿੱਥੇ ਹੋ ਤੁਸੀਂ ਨਾ ਇਸ ਟਾਈਮ ਠੀਕ ਹੈ ਸਰ ਆਪਣੇ ਕੋਲ ਫਰਨੀਚਰ ਮਤਲਬ ਬੈੱਡ ਵਗੈਰਾ ਹੁੰਦੇ ਨੇ ਜੀ ਠੀਕ ਆ ਸਰ ਸਰ ਸਾਨੂੰ ਬੈਡ ਦੀ ਰਿਕੁਾਇਰਮੈਂਟ ਸੀਗੀ ਜੀ ਇੱਕ ਅਤੇ ਇੱਕ ਸਾਨੂੰ ਸੋਫਿਆਂ ਦਾ ਸੈੱਟ ਚਾਹੀਦਾ ਸੀਗਾ ਹਾਂਜੀ ਅਤੇ ਹੋਰ ਵੀ ਜਿੰਨਾ ਆਪਣੇ ਘਰ ਲਈ ਫਰਨੀਚਰ ਹੁੰਦਾ ਜਿਹੜਾ ਮੈਂ ਨਾ ਸਰ ਬੈਂਕ ਦੇ ਵਿੱਚ ਜੋਬ ਕਰਦਾ ਹਾਂ ਅਤੇ ਮੇਰੀ ਟ੍ਰਾਂਸਫਰ ਇੱਧਰ ਲੁਧਿਆਣਾ ਹੋਈ ਸੀ ਮੈਨੂੰ ਫੜਨੀਚਰ ਦੀ ਲੋੜ ਸੀਗੀ ਕ ਦੋ ਟੇਬਲ ਚਾਹੀਦੇ ਆ ਸਾਨੂੰ ਅਤੇ ਦੋ ਚੇਅਰ ਮਿਲ ਜਾਣ ਕੰਪਿਊਟਰ ਟੇਬਲ ਹੋਵੇਗਾ ਆਪਣੇ ਕੋਲ ਹਾਂ ਜੀ ਸਰ ਇੱਕ ਕੰਪਿਊਟਰ ਟੇਬਲ ਚਾਹੀਦਾ ਸਾਨੂੰ ਸਰ ਦੋ ਸੋਫੇ ਅਤੇ ਦੋ ਚੇਅਰ ਚਾਹੀਦੀਆਂ ਨੇ ਸਾਨੂੰ ਸਰ ਅਤੇ ਇੱਕ ਬੈਡ ਚਾਹੀਦਾ ਸੀਗਾ ਹਾਂਜੀ ਸਰ ਤੁਸੀਂ ਸਰ ਸਾਨੂੰ ਵਟਸਐਪ 'ਤੇ ਕੁਛ ਫੋਟੋਸ ਭੇਜ ਸਕਦੇ ਹੋ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਜੀ ਅਤੇ ਸਰ ਜੇ ਹੁਣ ਜਿੱਦਾਂ ਅਸੀਂ ਸਾਰਾ ਫਰਨੀਚਰ ਇੱਕੋ ਵਾਰ ਦੇ ਵਿੱਚ ਪਰਚੇਸ ਕਰ ਰਹੇ ਹਾਂ ਤੁਹਾਡੇ ਤੋਂ ਤਾਂ ਤੁਸੀਂ ਸਾਨੂੰ ਕੁਛ ਡਿਸਕਾਊਂਟ ਵਗੈਰਾ ਦਿਓਂਗੇ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਸਰ ਅਸੀਂ ਜ਼ਰੂਰ ਵਿਜ਼ਿਟ ਕਰਾਂਗੇ ਤੁਹਾਡੇ ਕੋਲ ਤੁਸੀਂ ਆਪਣੀਆਂ ਵਾ ਵਟਸਐਪ ਦੇ ਉੱਪਰ ਲੋਕੇਸ਼ਨ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਇਸ ਨੰਬਰ ਦੇ ਉੱਤੇ ਠੀਕ ਆ ਸਰ ਠੀਕ ਆ ਅਤੇ ਸਰ ਆਪਣੇ ਕੋਲ ਬੈਡ ਦੇ ਲਈ ਮੈਟਰਸ ਵਗੈਰਾ ਹੁੰਦੇ ਆ ਓਕੇ ਸਰ ਠੀਕ ਹੈ ਸਰ ਸਰ ਤੁਹਾਡੇ ਕੋਲ ਕਿਡਸ ਦੇ ਲਈ ਕੋਈ ਛੋਟਾ ਫਰਨੀਚਰ ਅਵੇਲੇਬਲ ਹੈ ਠੀਕ ਹੈ ਸਰ ਸਾਨੂੰ ਨਾ ਸੀਠੀ ਵੀ ਚਾਹੀਦੀ ਸੀ ਇੱਕ ਸੀਠੀ ਅਵੇਲੇਬਲ ਹੈ ਠੀਕ ਹੈ ਸਰ ਹਾਂਜੀ ਸਰ ਜ਼ਰੂਰ ਆਵਾਂਗੇ ਜੀ ਠੀਕ ਆ ਸਰ ਠੀਕ ਆ ਜੀ ਹਾਂ ਜੀ ਸਰ ਮੈਂ ਨਾ ਤੁਹਾਡੀ ਯੂਟੀਊਬ ਦੇ ਉੱਪਰ ਇੱਕ ਵੀਡੀਓ ਦੇਖੀ ਸੀ ਤੁਸੀਂ ਫਰਨੀਚਰ ਪਬਲਿਸ਼ ਦੇ ਮਤਲਬ ਡਿਸਪਲੇ 'ਤੇ ਲਾਇਆ ਹੋਇਆ ਸੀਗਾ ਅਤੇ ਮੈਨੂੰ ਤੁਹਾਡਾ ਸ਼ੋਪ ਵੀ ਚੰਗੀ ਲੱਗੀ ਅਤੇ ਫਰਨੀਚਰ ਵੀ ਬਹੁਤ ਸੋਹਣਾ ਸੀਗਾ ਤਾਂ ਜੋ ਹਾਂਜੀ ਮੈਂ ਅ ਅਤੇ ਉੱਥੋਂ ਹੀ ਤੁਹਾਡਾ ਨੰਬਰ ਮੈਨੂੰ ਮਿਲਿਆ ਸੀਗਾ ਜੀ ਠੀਕ ਹੈ ਸਰ ਜ਼ਰੂਰ ਸ਼ੇਅਰ ਕਰਾਂਗੇ ਜੀ ਵੈਰੀ ਗੁੱਡ ਸਰ ਵੈਰੀ ਗੁੱਡ ਸਰ ਫਿਰ ਤਾਂ ਅਸੀਂ ਜ਼ਰੂਰ ਆਵਾਂਗੇ ਮੈਂ ਆਪਣੇ ਫੈਮਲੀ ਨਾਲ ਲੈ ਕੇ ਤੁਹਾਡੇ ਸ਼ੋਪ 'ਤੇ ਵਿਜਿਟ ਕਰਾਂਗੇ ਸਰ ਠੀਕ ਆ ਸਰ ਸਰ ਆਪਣੇ ਕੋਲ ਇੱਕ ਚੇਅਰਸ ਹੁੰਦੀਆਂ ਨੇ ਜਿੱਦਾਂ ਲੱਕੜ ਦੀਆਂ ਲੱਕੜ ਦੀ ਚੇਅਰਸ ਹੁੰਦੀਆਂ ਨੇ ਨਾ ਬੈਂਤ ਨਾਲ ਬੁਣੀਆਂ ਹੋਈਆਂ ਹਾਂਜੀ ਪੁਰਾਣੇ ਸਟਾਈਲ ਦੀਆਂ ਨਹੀਂ ਹੁੰਦੀਆਂ ਜਿੱਦਾਂ ਬੈਂਤ ਨਾਲ ਬੁਣੀਆ ਹੋਈਆਂ ਚੇਅਰਸ ਹਾਂ ਜੀ ਹਾਂ ਜੀ ਉਹ ਵੀ ਸਾਨੂੰ ਚਾਹੀਦੀਆਂ ਨੇ ਚਾਰ ਪੰਜ ਕੁਰਸੀਆਂ ਜੀ ਠੀਕ ਆ ਸਰ ਥੈਂਕ ਯੂ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੀ ਲੋਕੇਸ਼ਨ ਸਾਨੂੰ ਸੈਂਡ ਕਰ ਦਿਓ ਓਕੇ ਜੀ ਓਕੇ